ਨਵੇਂ ਜਨਮੇ ਬੱਚੇ ਨੂੰ ਬਿਮਾਰੀ ਤੋਂ ਬਚਾਉਣ ਲਈ ਬਹੁਤ ਹੀ ਸਾਫ ਸੁਥਰੇ ਵਾਤਾਵਰਨ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਉਹ ਕਿਸ ਕਮਰੇ ਵਿੱਚ ਰਹਿੰਦਾ ਹੈ ਉਸ ਕਮਰੇ ਵਿੱਚ ਹੱਥ ਧੋ ਕੇ ਹੀ

ਬਹੁਤ ਹੀ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ ਸੋ ਨਵੇਂ ਜਨਮੇ ਬੱਚੇ ਨੂੰ ਜਦੋਂ ਵੀ ਕੋਈ ਬੰਦਾ ਚੁੱਕਦਾ ਹੈ ਤਾਂ ਉਹਨਾਂ ਨੂੰ ਹਮੇਸ਼ਾ ਗਲੱਬਸ ਜਾਂ ਸੈਨੀਟਾਈਜ਼ਰ ਨਾਲ ਹੱਥ ਧੋ ਕੇ ਹੀ ਚੁੱਕਣਾ ਚਾਹੀਦਾ ਹੈ